ਪੰਜਾਬੀ ਭਾਸ਼ਾ ਦੇਵਨਾਗਰੀ 'ਚੋਂ ਕੱਢੀ ਹੋਈ ਭਾਸ਼ਾ ਹੈਗੀ ਆਗੀ ਹੈ ਹਿੰਦੀ ਹਿੰਦੀ ਤੋਂ ਕਾਫ਼ੀ ਜ਼ਿਆਦਾ ਲਿੱਤੀ ਹੋਈ ਆ ਭਾਸ਼ਾ ਹੈਗੀ ਹੈਗੀ ਹੈ ਹਿੰਦੀ ਵਿ ਹਿੰਦੀ ਤੋਂ ਕਾਫੀ ਜ਼ਿਆਦਾ ਲਿੱਤੀ ਹੋਈ ਇਹ ਭਾਸ਼ਾ ਹੈ ਹਿੰਦੀ ਦੇ ਕਾਫੀ ਸਾਰੇ ਸ਼ਬਦ ਹੈਗੇ ਜਿਹੜੇ ਇਹਦੇ ਵਿੱਚ ਵਰਤੇ ਜਾਂਦੇ ਹਨ ਅਤੇ ਆ ਪੰਜਾਬੀ ਭਾਸ਼ਾ ਵਿੱਚ ਵੀ ਕਾਫ਼ੀ ਵੱਖ ਵੱਖ ਭਾਸ਼ਾਵਾਂ ਹੈਗੀਆਂ ਜਿਵੇਂ ਅ ਜਿੱਦਾਂ ਹਿੰਦੀ ਤਾਂ ਇੱਕ ਹੀ ਭਾਸ਼ਾ ਹੈਗੀ ਨਾ ਹਰ ਜਗ੍ਹਾ ਇੱਕ ਤਰੀਕੇ ਦੀ ਹਿੰਦੀ ਬੋਲੀ ਜਾਂਦੀ ਹੈਗੀ ਪਰ ਪੰਜਾਬੀ ਭਾਸ਼ਾ ਤਾਂ ਹਰ ਇੱਕ ਜਗ੍ਹਾ ਦੀ ਹਰ ਇੱਕ ਸ਼ਹਿਰ ਦੀਆਂ ਵੱਖਰੀਆਂ ਵੱਖਰੀਆਂ ਪੰਜਾਬੀ ਭਾਸ਼ਾ ਹੈਗੀ ਅਤੇ ਕਾਫ਼ੀ ਸਾਰੇ ਸਰੂਪ ਹੈਗੇ ਇਹਦੇ ਵਰਣਮਾਲਾ ਕਾਫ਼ੀ ਵੱ ਵਧੀਆ ਤਰੀਕੇ ਨਾਲ ਬਣਾਈ ਜਾਂਦੀ ਕਿ ਹਰ ਇੱਕ ਕਿਵੇਂ ਕੋਈ ਇੱਕ ਸ਼ਬਦ ਦੇ ਵਿੱਚ ਅਤੇ ਥੱਲੇ ਇੱਕ ਬਿੰਦੀ ਵੀ ਆ ਜਵੇ ਤਾਂ ਉਹਦੀ ਭਾਸ਼ਾ ਦਾ ਸ਼ਬਦ ਦਾ ਬੋਲਣ ਦਾ ਤਰੀਕਾ ਚੇਂਜ ਹੋ ਜਾਂਦਾ ਵਾ ਹੈਗਾ ਅਤੇ ਇਹਦੇ ਵਿੱਚ ਹੋਰ ਵੀ ਬਥੇਰੀਆਂ ਚੀਜ਼ਾਂ ਵਾ ਜਿਵੇਂ ਪੰਜਾਬੀ ਵੱਖ ਹੁੰਦੀ ਹੈ ਬਾਕੀ ਲੈਂਗ ਬਾਕੀ ਭਾਸ਼ਾਵਾਂ ਤੋਂ ਸੰਸਕ੍ਰਿਤ ਤੋਂ ਇੰਸਪਾਇਰ ਹੋਈ ਹੋਈ ਭਾਸ਼ਾ ਹੈਗੀ ਇਹ ਕਾਫ਼ੀ ਪੁਰਾਣੀ ਅਤੇ ਲੋਕਾਂ ਵਲੋਂ ਯੂਜ਼ ਕੀਤੀ ਗਈ ਭਾਸ਼ਾ ਹੈਗੀ